ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਆਪਣੇ ਵਿਦਿਆਰਥੀਆਂ ਦੀ ਸੱਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ ਦੇ ਮੁੱਦੇ ਨੂੰ ਹੱਲ ਕਰਦੀ ਹੈ ਉਹ ਇਸ ਤਰ੍ਹਾਂ ਹੈ ਕਿ ਪੰਜਾਬ ਦੇ ਅਧਿਆਪਕਾਂ ਨੂੰ ਇਹੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਜਦੋਂ ਤੁਸੀਂ ਜਮਾਤ ਵਿੱਚ ਆਪਣੇ ਆਪਣੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨੀ ਹੈ ਅਤੇ ਉਹਦੇ ਵਿੱਚ ਉਹਨਾਂ ਉੱਪਰ ਆਪਣੀ ਭਾਸ਼ਾ ਨੂੰ ਥੋਪਿਆ ਨਾ ਜਾਵੇ ਉਹਨਾਂ ਨੂੰ ਇਸ ਤਰੀਕੇ ਸਮਝਾਇਆ ਜਾਵੇ ਕਿ ਉਹ ਆਪਣੇ ਗਿਆਨ ਨੂੰ ਆਪਣੀ ਭਾਸ਼ਾ ਵਿੱਚ ਵੀ ਪ੍ਰਗਟ ਕਰ ਸਕਦੇ ਹਨ ਇਸੇ ਲਈ ਪੇਪਰਾਂ ਦਾ ਵੀ ਜਦੋਂ ਕੰਮ ਹੁੰਦਾ ਅਤੇ ਉਹਦੇ ਵਿੱਚ ਵੀ ਉਹਨਾਂ ਨੂੰ ਲੈਂਗੁਏਜ ਦੇ ਉੱਪਰ ਮਤਲਬ ਉਹਨਾਂ ਦੀ ਆਪਣੀ ਭਾਸ਼ਾ ਦੇ ਵਿੱਚ ਪੇਪਰ ਹੱਲ ਕਰਨ ਦਾ ਹੀ ਇੱਕ ਸਮੱਸਿਆ ਦਾ ਹੱਲ ਵਜੋਂ ਦਿੱਤਾ ਜਾਂਦਾ ਕੋਈ ਵੀ ਹਿੰਦੀ ਵਿੱਚ ਵੀ ਪੇਪਰ ਲਿਖ ਸਕਦਾ ਹੈ ਪੰਜਾਬੀ ਆਪਣੀ ਮਾਤ ਭਾਸ਼ਾ ਵਿੱਚ ਵੀ ਜਾਂ ਉਹ ਅੰਗਰੇਜ਼ੀ ਦੇ ਵਿੱਚ ਵੀ ਲਿਖ ਸਕਦਾ ਹੈ ਇਹੀ ਤਰੀਕਾ ਹੈ ਤਾਂ ਹੀ ਪੰਜਾਬ ਆਪਣੀ ਸਿੱਖਿਆ ਪ੍ਰਣਾਲੀ ਵਿੱਚ ਬਾਕੀ ਦੇ ਰਾਜਾਂ ਤੋਂ ਕਿਤੇ ਉੱਪਰ ਹੈ ਅਤੇ ਉਹਦੇ ਵਿਦਿਆਰਥੀ ਆਪਣੇ ਸੱਭਿਆਚਾਰ ਦੇ ਨਾਲ ਨਾਲ ਆਪਣੀ ਭਾਸ਼ਾਈ ਵਿਭਿੰਨਤਾ ਨੂੰ ਵੀ ਅੱਗੇ ਲੈ ਕੇ ਜਾ ਰਹੇ ਹਨ